ਹਾਂਜੀ ਪੰਜਾਬ ਦੇ ਵਿੱਚ ਬਹੁਤ ਹੀ ਵਧੀਆ ਗੌਰਮੈਂਟ ਅਤੇ ਪ੍ਰਾਈਵੇਟ ਕੋਲੇਜਿਸ ਸਾਡੇ ਲਈ ਉਪਲਬਧ ਹਨ ਜਿਨ੍ਹਾਂ ਦੇ ਵਿੱਚ ਜਾ ਕੇ ਅਸੀਂ ਵਧੀਆ ਪੜ੍ਹਾਈ ਕਰ ਸਕਦੇ ਹਾਂ ਅਤੇ ਅਸੀਂ ਕਹਿਲਾ ਸਕਦੇ ਕਿ ਅਸੀਂ ਨੇ ਗ੍ਰੈਜੂਏਸ਼ਨ ਇਸ ਕਾਲਜ ਵਿੱਚੋਂ ਕੀਤੀ ਹੈ ਕਈ ਬੱਚਿਆਂ ਦਾ ਸੁਪਨਾ ਹੁੰਦਾ ਹੈ ਕਿ ਅਸੀਂ ਗੌਰਮੈਂਟ ਕੋਲੇਜ ਜਾਂ ਪ੍ਰਾਈਵੇਟ ਕੋਲੇਜਿਸ ਦੇ ਵਿੱਚ ਸਟੱਡੀ ਕਰੀਏ ਪੰਜਾਬ ਦੇ ਅਤੇ ਬਹੁਤ ਹੀ ਬੱਚੇ ਹੁੰਦੇ ਹਨ ਜੋ ਕਿ ਆਪਣਾ ਸੁਪਨਾ ਪੂਰਾ ਕਰਨ ਦੇ ਲਈ ਪੰਜਾਬ ਆਉਂਦੇ ਹਨ ਪਹਿਲਾਂ ਤਾਂ ਗੌਰਮੈਂਟ ਕੋਲਜ ਆਉਂਦੇ ਹਨ ਪਹਿਲਾ ਪੰਜਾਬੀ ਯੂਨੀਵਰਸਿਟੀ ਚੰਡੀਗੜ੍ਹ ਦੂਸਰਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੀਸਰਾ ਖ਼ਾਲਸਾ ਕੋਲਜ ਅੰਮ੍ਰਿਤਸਰ ਚੌਥਾ ਗੁਰੂ ਨਾਨਕ ਦੇਵ ਅੰਮ੍ਰਿਤਸਰ ਪੰਜਵਾਂ ਪੰਜਾਬ ਐਗਰੀਕਲਚਰ ਲੁਧਿਆਣਾ ਛੇਵਾਂ ਗੌਰਮੈਂਟ ਕੋਲੇਜ ਰੋਪੜ ਸੱਤਵਾਂ ਰਾਜੀਵ ਗਾਂਧੀ ਯੂਨੀਵਰਸਿਟੀ ਪਟਿਆਲਾ ਅੱਠਵਾਂ ਜੀ ਐਨ ਏ ਯੂਨੀਵਰਸਿਟੀ ਨੌਵਾਂ ਬਾਬਾ ਫਰੀਦ ਯੂਨੀਵਰਸਿਟੀ ਇਹ ਸਾਰੀਆਂ ਹੀ ਗੌਰਮੈਂਟ ਯੂਨੀਵਰਸਿਟੀਜ਼ ਹਨ ਅਤੇ ਇੱਥੇ ਬੱਚੇ ਪੜ੍ਹਾਈ ਕਰਨ ਲਈ ਆਉਂਦੇ ਹਨ ਅਤੇ ਇੱਥੇ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਬੱਚਿਆਂ ਨੂੰ ਸਰਟੀਫਿਕੇਟਸ ਪ੍ਰੋਵਾਈਡ ਕੀਤੇ ਜਾਂਦੇ ਹਨ ਅਤੇ ਅੱਗੇ ਉਹਨਾਂ ਨੇ ਜਦੋਂ ਜੋਬ 'ਤੇ ਜਾਣਾ ਹੁੰਦਾ ਨੌਕਰੀ 'ਤੇ ਜਾਣਾ ਹੁੰਦਾ ਹੈ ਜਾਂ ਉੱਧਰ ਨੌਕਰੀ ਕਰਨ ਦੇ ਲਈ ਇੰਟਰੋਡਕਸ਼ਨ ਆਪਣਾ ਪਰਿਚੈ ਦੇਣ ਲਈ ਜਾਣਾ ਹੁੰਦਾ ਹੈ ਤਾਂ ਉਹ ਸਾਡਾ ਡੋਕੂਮੈਂਟ ਦੇ ਤੌਰ 'ਤੇ ਸਰਟੀਫਿਕੇਟ ਵੀ ਮੰਗਦੇ ਹਨ ਗ੍ਰੈਜੂਏਸ਼ਨ ਦਾ ਕਾਲਜ ਦਾ ਅਤੇ ਅਸੀਂ ਉਹਨਾਂ ਨੂੰ ਆਪਣਾ ਸਰਟੀਫਿਕੇਟ ਦੇ ਕੇ ਆਪਣੀ ਵਧੀਆ ਜੋਬਸ ਪਾ ਸਕਦੇ ਹੈ ਉਸ ਤੋਂ ਬਾਅਦ ਪ੍ਰਾਈਵੇਟ ਕੌਲੇਜਿਸ ਆ ਗਏ ਪਹਿਲਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀਸ ਦੂਸਰਾ ਰੈਂਮਟ ਯੂਨੀਵਰਸਿਟੀ ਖੰਨਾ ਤੀਸਰਾ ਰਿਆਤ ਬਾਹਰਾ ਯੂਨੀਵਰਸਿਟੀਜ ਚੌਥਾ ਥਾਪਰ ਯੂਨੀਵਰਸਿਟੀ ਪੰਜਵਾਂ ਐਗਰੀਕਲਚਰ ਯੂਨੀਵਰਸਿਟੀਜ ਛੇਵਾਂ ਐੱਲ ਪੀ ਯੂ ਇਹ ਸਾਰੇ ਪੰਜਾਬ ਦੇ ਪ੍ਰਾਈਵੇਟ ਕੋਲੇਜਿਸ ਹਨ ਜਿਨ੍ਹਾਂ ਦੇ ਵਿੱਚ ਅਸੀਂ ਓਪਨ ਦੇ ਵਿੱਚ ਸਟੱਡੀ ਕਰ ਸਕਦੇ ਹਾਂ ਓਪਨ ਦੇ ਵਿੱਚ ਸਟੱਡੀ ਕਰਨ ਦੇ ਵਿੱਚ ਇਹ ਹੈ ਕਿ ਅਸੀਂ ਘਰ ਬੈਠੇ ਔਨਲਾਈਨ ਪੜ੍ਹਾਈ ਕਰ ਸਕਦੇ ਹਾਂ ਅਤੇ ਅਸੀਂ ਕੋਲੇਜ ਸਿਰਫ਼ ਇੱਕ ਦਿਨ ਜਾਣਾ ਹੁੰਦਾ ਜਦੋਂ ਅਸੀਂ ਨੇ ਪੇਪਰ ਦੇਣੇ ਹੁੰਦੇ ਹਨ ਪੇਪਰ ਦੇਣ ਤੋਂ ਬਾਅਦ ਸਾਨੂੰ ਸਰਟੀਫਿਕੇਟ ਹੈ ਜੋ ਦਿੱਤੇ ਜਾਂਦੇ ਹਨ ਸਾਡੀ ਗ੍ਰੈਜੂਏਸ਼ਨ ਪਾਸ ਕੀਤੀ ਦੇ ਅਤੇ ਉਸ ਤੋਂ ਬਾਅਦ ਸਾਨੂੰ ਪੈਕੇਜ ਨੇ ਗੁੱਡ ਪੈਕੇਜ ਸਟਾਰਟਿੰਗ 'ਚ ਦਿੱਤੇ ਜਾਂਦੇ ਹੈ ਪੰਜ ਕੇ ਤੋਂ ਅੱਠ ਕੇ ਪਰ ਸਾਨੂੰ ਰਿਪਲੇਸਮੈਂਟ ਪ੍ਰਾਈਵੇਟ ਪ੍ਰੋਵਾਈਡ ਕੀਤੀ ਜਾਂਦੀ ਹੈ ਅਤੇ ਗੌਰਮੈਂਟ ਅਤੇ ਪ੍ਰਾਈਵੇਟ ਕੋਲੇਜਿਸ ਦੇ ਵਿੱਚ ਪੜ੍ਹਾਈ ਬਹੁਤ ਹੀ ਵਧੀਆ ਤੌਰ 'ਤੇ ਕਰਵਾਈ ਜਾਂਦੀ ਹੈ ਵਧੀਆ ਬੜੇ ਹੀ ਵਧੀਆ ਤਰੀਕੇ ਨਾਲ ਕਰਵਾਈ ਜਾਂਦੀ ਹੈ ਅਤੇ ਇੱਥੇ ਬੜੇ ਹੀ ਸਾਫ਼ ਰੱਖੇ ਜਾਂਦੇ ਹਨ ਕੋਲੇਜ ਬੜੇ ਹੀ ਸਾਫ਼ ਸੁਥਰੇ ਕੋਲੇਜ ਬਣੇ ਹੋਏ ਹਨ ਅਤੇ ਗੌਰਮੈਂਟ ਕਾਲਜ ਦੇ ਵਿੱਚ ਹੋਸ਼ਟਲਸ ਵੀ ਪ੍ਰੋਵਾਈਡ ਕੀਤੇ ਜਾਂਦੇ ਹਨ ਜਿਹੜੇ ਬੱਚੇ ਕਾਫ਼ੀ ਦੂਰ ਤੋਂ ਆਉਂਦੇ ਹਨ ਉਹਨਾਂ ਲਈ ਹੋਸਟਲਸ ਹੁੰਦੇ ਹਨ ਅਤੇ ਉਹ ਹੋਸਟਲ ਦੇ ਵਿੱਚ ਹੀ ਰਹਿੰਦੇ ਹਨ ਗੌਰਮੈਂਟ ਕਾਲਜ ਦੇ ਵਿੱਚ ਫ਼ੀਸ ਘੱਟ ਹੁੰਦੀ ਹੈ ਅਤੇ ਪ੍ਰਾਈਵੇਟ ਕਾਲਜ ਦੇ ਵਿੱਚ ਫ਼ੀਸ ਜ਼ਿਆਦਾ ਹੁੰਦੀ ਹੈ ਜਿਹੜੇ ਬੱਚੇ ਜੋਬ ਕਰਨਾ ਚਾਹੁੰਦੇ ਹਨ ਸਟੱਡੀ ਦੇ ਨਾਲ਼ ਨਾਲ਼ ਉਹ ਪ੍ਰਾਈਵੇਟ ਕੋਲੇਜਿਸ ਨੂੰ ਚੂਜ਼ ਕਰਦੇ ਹਨ ਅਤੇ ਜਿਹੜੇ ਬੱਚੇ ਜੋਬ ਨਹੀਂ ਕਰਨਾ ਚਾਹੁੰਦੇ ਜਾਂ ਜੋ ਪਾਰਟ ਟਾਈਮ 'ਤੇ ਕਰਨਾ ਚਾਹੁੰਦੇ ਹਨ ਉਹ ਗੌਰਮੈਂਟ ਜੋਬ ਨੂੰ ਚੂਜ਼ ਕਰਦੇ ਹਨ ਅਤੇ ਦੋਨੋਂ ਹੀ ਗੌਰਮੈਂਟ ਪ੍ਰਾਈਵੇਟ ਕੋਲੇਜਿਸ ਦੇ ਵਿੱਚ ਸਟੱਡੀ ਵਧੀਆ ਕਰਵਾਈ ਜਾਂਦੀ ਹੈ